ਖਾਣਾ ਪਕਾਉਣ ਵੇਲੇ ਅਸੀਂ ਪਿੱਤਲ ਅਤੇ ਲੋਹੇ ਦੇ ਬਰਤਨ ਵਰਤਦੇ ਹਾਂ ਸਭ ਨਾਲੋਂ ਬੈਸਟ ਕੁਆਲਿਟੀ ਮੰਨੀ ਜਾਂਦੀ ਹੈ ਇਹ ਜਿਹੜਾ ਲੋਹਾ ਇਹਦੇ ਵਿੱਚ ਆਇਰਨ ਬਹੁਤ ਪਾਇਆ ਜਾਂਦਾ ਹੈ ਜਿਸ ਤਰ੍ਹਾਂ ਆਇਰਨ ਦੀ ਕਮੀ ਨਹੀਂ ਹੋਣ ਦਿੰਦਾ ਅਤੇ ਪਿੱਤਲ ਆ ਜਿਹੜਾ ਇਹਦੇ ਵਿੱਚ ਖਣਿਜ ਪਦਾਰਥ ਕਾਫੀ ਪਾਈ ਜਾਂਦੇ ਹਨ ਇਹਨਾਂ ਦੇ ਵਿੱਚ ਭੋਜਨ ਦਾ ਟੇਸਟ ਵੀ ਅਲੱਗ ਹੀ ਹੁੰਦਾ ਹੈ ਬਾਕੀ ਆਪਣੇ ਸਰੀਰ ਦੀ ਤੰਦਰੁਸਤੀ ਲਈ ਵੀ ਇਹ ਬਰਤਨ ਵਧੀਆ ਨੇ ਇਸ ਤਰ੍ਹਾਂ ਇਹਨਾਂ ਨੂੰ ਮੈਂ ਇਹੀ ਦੋਨੋਂ ਬਰਤਨ ਜ਼ਿਆਦਾ ਪਸੰਦ ਕਰਦੀ ਹਾਂ ਅਤੇ ਮੈਂ ਵਰਤਦੀ ਵੀ ਇਹੀ ਆ